ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੋਰ ਦੱਸੋ ਕੀ ਹਾਲ ਹੈ ਜੀ ਹਾਂਜੀ ਵਧੀਆ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਬਸ ਤੁਹਾਨੂੰ ਪਤਾ ਹੀ ਹੈ ਮੈਮ ਹੁਣ ਤਾਂ ਜੀ ਲਾਉਣਾ ਹੀ ਪੈਣਾ ਗਾ ਮੈਂ ਜਦੋਂ ਸ਼ਿਫਟਿੰਗ ਹੋ ਹੀ ਗਈ ਆ ਹਾਂਜੀ ਇਹ ਤਾਂ ਹੈ ਹਾਂਜੀ ਅਤੇ ਮੈਂ ਤੁਹਾਨੂੰ ਇਸ ਗੱਲ ਵਾਸਤੇ ਕਾਲ ਲਾਈ ਸੀ ਬੀ ਮੈਨੇ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਉਣੀ ਆ ਆਪਣੇ ਤੁਹਾਨੂੰ ਪਤਾ ਵੀ ਤੁਸੀਂ ਪਹਿਲਾਂ ਦੇ ਰਹਿੰਦੇ ਹੋ ਇੱਥੇ ਅਤੇ ਅਤੇ ਮੈਨੂੰ ਐਂ ਕੋਈ ਸਕੂਲ ਵਧੀਆ ਜਿਹਾ ਪੁੱਛ ਕੇ ਦੱਸ ਦਿਉ ਜੀ ਵੀ ਕੋਈ ਵਧੀਆ ਵੀ ਮੈਂ ਸੀ ਬੀ ਐਸ ਈ ਲਾ ਸੀ ਬੀ ਐਸ ਈ ਲਵਾ ਸੀ ਬੀ ਐਸ ਈ ਲਵਾਉਂਦੀ ਹਾਂ ਮੈਮ ਅਤੇ ਵੀ ਪਤਾ ਲੱਗ ਜਾਵੇ ਨਾ ਵੀ ਕੋਈ ਮ ਕਿਉਂਕਿ ਉੱਥੇ ਵੀ ਬੱਚੇ ਸੀ ਬੀ ਐਸ ਈ 'ਚ ਹੀ ਪੜ੍ਹਦੇ ਸੀਗੇ ਪਹਿਲਾਂ ਅਤੇ ਸੀ ਬੀ ਐਸ ਈ ਲਵਾਉਣੇ ਆਂ ਮੈਂ ਤੁਸੀਂ ਦੇਖ ਕੇ ਦੱਸ ਦਿਓ ਵੀ ਕਿਹੜਾ ਸਕੂਲ ਵਧੀਆ ਰਹਿਣਾ ਵੀ ਜਿੱਥੇ ਪੜ੍ਹਾਈ ਵੀ ਵਧੀਆ ਹੋਵੇ ਹਾਂਜੀ ਅੱਛਾ ਜੀ ਠੀਕ ਹੈ ਜੀ ਫੇਰ ਉਹ ਬਸ ਉਹੀ ਫਿਰ ਆਪਾਂ ਹਾਂਜੀ ਅੱਛਾ ਜੀ ਠੀਕ ਹੈ ਜੀ ਓਕੇ ਜੀ ਹਾਂਜੀ ਹਾਂਜੀ ਓਕੇ ਜੀ ਓਕੇ ਜੀ ਹਾਂਜੀ ਹਾਂਜੀ ਓਕੇ ਜੀ ਹਾਂਜੀ ਸੌਖਾ ਹੋ ਜਾਂਦਾ ਅਤੇ ਇੱਥੇ ਵੈਨ ਵਗੈਰਾ ਵੀ ਲੱਗੀਆਂ ਹੋਣਗੀਆਂ ਬੱਚਿਆਂ ਨੂੰ ਜੀ ਓ ਓਕੇ ਜੀ ਹਾਂਜੀ ਅਤੇ ਦੇਖ ਲਓ ਫਿਰ ਮੈਮ ਜਦੋਂ ਤੁਸੀਂ ਮਤਲਬ ਕਿ ਮੰਡੇ ਨੂੰ ਤੁਸੀਂ ਫਰੀ ਹੋ ਹਾਂਜੀ ਫਿਰ ਆਪਾਂ ਐਂ ਕਰਾਂਗੇ ਮੰਡੇ ਨੂੰ ਫਿਰ ਤੁਸੀਂ ਮੇਰੇ ਨਾਲ ਚਲੇ ਜਾਇਓ ਆਪਾਂ ਗੱਲਬਾਤ ਕਰ ਆਵਾਂਗੇ ਸਕੂਲ ਦੇ ਵਿੱਚ ਜਾ ਕੇ ਹਾਂਜੀ ਨਹੀਂ ਜੇ ਆਪਾਂ ਫਿਰ ਐਂ ਐਂ ਕਰਾਂਗੇ ਨਾ ਵੀ ਬੱ ਬੱਚਿਆਂ ਦੀ ਵੀ ਐਡਮਿਸ਼ਨ ਕਰਵਾ ਹੀ ਆਵਾਂਗੇ ਆਪਾਂ ਮੰਡੇ ਨੂੰ ਚੱਲ ਵੜਾਂਗੇ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈ ਜੀ ਬਸ ਫਿਰ ਤੁਸੀਂ ਦੇਖਿਓ ਅਤੇ ਫਿਰ ਆਪਾਂ ਮੰਡੇ ਨੂੰ ਦੇਖਦੇ ਹਾਂ ਜੀ ਮੰਡੇ ਨੂੰ ਚੱਲ ਆਵਾਂਗੇ ਅਤੇ ਬੱਚਿਆਂ ਦੀ ਐਡਮਿਸ਼ਨ ਕਰਵਾ ਆਵਾਂਗੇ ਹਾਂਜੀ ਓਕੇ ਜੀ ਓਕੇ ਜੀ ਹੋਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਸ ਜੀ ਮੈਂ ਏਂਈਂ ਪੁੱਛਣਾ ਸੀ ਫਿਰ ਮੈਂ ਕਿਹਾ ਚਲੋ ਆਪਾਂ ਚੱਲ ਕੇ ਐਡਮਿਸ਼ਨ ਕਰਵਾ ਕੇ ਚਲੋ ਫਿਰ ਉਹ ਕਰ ਲਵਾਂਗੇ ਬੱਚੇ ਸਕੂਲ ਜਾਣ ਲੱਗ ਜਾਣਗੇ ਚਲੋ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ ਓਕੇ ਜੀ